ਕੁਝ ਆਮ ਗਲਤੀਆਂ ਜੋ ਹਰ ਇੱਕ ਕਲਾਕਾਰ ਸ਼ੁਰੂ ਸ਼ੁਰੂ ਤੋਂ ਫ੍ਰੈਸ਼ਰ ਹਰ ਇੱਕ ਕਰਦਾ ਹੈ ਜਿਹੜੇ ਕਿ ਕੁਛ ਇਸ ਪ੍ਰਕਾਰ ਹਨ ਕਿ ਜਿਵੇਂ ਕੋਈ ਨਵਾਂ ਨਵਾਂ ਕਲਾਕਾਰ ਉੱਠਦਾ ਹੈ ਕੋਈ ਵੀ ਚਿੱਤਰ ਬਣਾਉਂਦਾ ਹੈ ਕਿਸੇ ਵੀ ਪ੍ਰਕਾਰ ਦੀ ਪਹਿਲਾਂ ਤਾਂ ਉਹ ਲਾਈਨਾਂ ਮਾਰਦਾ ਹੈ ਫਿਰ ਹੌਲੀ ਹੌਲੀ ਆਪਣੇ ਉਸਤਾਦ ਕੋਲੋਂ ਸਿੱਖਦਾ ਹੈ ਕਿ ਉਸਨੇ ਕਿਸ ਤਰ੍ਹਾਂ ਬਣਾਉਣਾ ਹੈ ਉਸਦੀ ਕੀ ਐਂਗਲ ਹੈ ਉਸਦਾ ਕੀ ਸ਼ੇਪ ਹੈ ਕਿਸ ਪ੍ਰਕਾਰ ਦੀ ਡਰਾਇੰਗ ਦਿਖ ਰਹੀ ਹੈ ਕਿੱਧਰੋਂ ਕਿਹੜੀ ਸ਼ੇਪ ਲਿਆਉਣੀ ਹੈ ਕਿੱਧਰੋਂ ਕਿਹੜੀ ਸ਼ੇਪ ਨਹੀਂ ਲਿਆਉਣੀ ਹੈ ਕਿਹੜੀ ਚੀਜ਼ ਮੋਟੀ ਰੱਖਣੀ ਹੈ ਕਿਹੜੀ ਚੀਜ਼ ਪਤਲੀ ਰੱਖਣੀ ਹੈ ਅੱਖਾਂ ਕਿੱਦਾਂ ਦੀਆਂ ਰੱਖਣੀਆਂ ਹਨ ਖੁੱਲ੍ਹੀਆਂ ਰੱਖਣੀਆਂ ਹਨ ਹਰ ਇੱਕ ਚੀਜ਼ ਜਿਹੜੀ ਰੀਅਲ ਦਿਖੇ ਪਰ ਸਭ ਤੋਂ ਪਹਿਲਾਂ ਉਸਨੂੰ ਪੈਂਨਸਿਲ ਫੜਨ ਦੀ ਜਾਚ ਹੋਣੀ ਚਾਹੀਦੀ ਹੈ ਕਿ ਪੈਂਨਸਿਲ ਕਿਵੇਂ ਚਲਾਉਣੀ ਹੈ ਅਤੇ ਕਿਵੇਂ ਨਹੀਂ ਚਲਾਉਣੀ ਹੈ ਪੈਂਨਸਿਲ ਨੂੰ ਕਿੱਥੇ ਡਾਰਕ ਯੂਜ਼ ਕਰਨਾ ਹੈ ਕਿੱਥੇ ਘੱਟ ਯੂਜ਼ ਕਰਨਾ ਹੈ ਕਿੱਥੇ ਹਲਕੀ ਸ਼ੇਡਿੰਗ ਕਰਨੀ ਹੈ ਕਿੱਥੇ ਜ਼ਿਆਦਾ ਸ਼ੇਡਿੰਗ ਕਰਨੀ ਹੈ ਕਿੱਥੇ ਬਰੱਸ਼ ਦੀ ਲੋੜ ਹੈ ਕਿੱਥੇ ਰਬੜ ਦੀ ਲੋੜ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਪੇਂਟਿੰਗ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਜੋ ਕਿ ਹਰ ਕੋਈ ਵਿਅਕਤੀ ਬਣਾਉਣ ਸਮੇਂ ਲਈ ਕਰਦਾ ਹੈ ਗਲਤੀਆਂ ਇਹਨਾਂ ਗਲਤੀਆਂ ਤੋਂ ਹੀ ਜਦੋਂ ਆਪਣੇ ਉਸਤਾਦ ਨੂੰ ਦਿਖਾਉਣ ਜਾਂਦਾ ਹੈ ਇਹਨਾਂ ਗਲਤੀਆਂ ਨੂੰ ਫਿਰ ਉਹ ਬਾਅਦ ਵਿੱਚ ਸੁਧਾਰਦਾ ਹੈ ਉਸਦਾ ਉਸਦਾ ਉਸਤਾਦ ਉਹਨੂੰ ਦੱਸਦਾ ਹੈ ਕਿ ਇਸ ਦੀ ਸ਼ੇਪ ਇੱਥੋਂ ਇਧਰਾਂ ਵਿੰਗੀ ਜਾਣੀ ਹੈ ਇੱਥੋਂ ਤਾਂ ਸਿੱਧੀ ਜਾਣੀ ਹੈ ਇਸ ਤੋਂ ਬਾਅਦ ਇਹਨਾਂ ਗਲਤੀਆਂ ਨੂੰ ਸੁਧਾਰਦਾ ਹੈ ਅਤੇ ਉਹਨਾਂ ਤੋਂ ਕਿਵੇਂ ਬਚ ਸਕਦੇ ਹਾਂ ਉਹਨਾਂ ਤੋਂ ਆਪਾਂ ਇਵੇਂ ਬਚ ਸਕਦੇ ਹਾਂ ਕਿ ਹਰ ਇੱਕ ਚੀਜ਼ ਨੂੰ ਤੁਹਾਨੂੰ ਪਤਾ ਹੀ ਹੈ ਕਿ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਪ੍ਰੈਕਟਿਸ ਕਰ ਕਰਕੇ ਇੱਕੋ ਚੀਜ਼ ਨੂੰ ਬਾਰ ਬਾਰ ਬਣਾ ਕੇ ਆਪਾਂ ਉਸ 'ਤੇ ਆਪਣਾ ਹੰਡਰਡ ਪ੍ਰਸੈਂਟ ਦੇ ਸਕਦੇ ਹਾਂ ਇਸ ਤਰ੍ਹਾਂ ਹੀ ਬਾਰ ਬਾਰ ਅਭਿਆਸ ਦੀ ਲੋੜ ਹੈ ਅਭਿਆਸ ਦੀ ਬਿਲਕੁਲ ਜ਼ਿਆਦਾ ਹੀ ਲੋੜ ਹੈ ਉਸ ਵਿੱਚ ਬਾਰ ਬਾਰ ਇੱਕੋ ਚੀਜ਼ ਨੂੰ ਬਣਾਈ ਜਾਵਾਂਗੇ ਤਾਂ ਆਪਾਂ ਕਰ ਸਕਦੇ ਹਾਂ ਇਸ ਨਾਲ ਆਲ ਡਰਾਇੰਗ 'ਚ ਪਰਫੈਕਟ ਹੋ ਜਾਂਦਾ ਹੈ ਅਤੇ ਉਸਦੀ ਡਰਾਇੰਗ ਬਹੁਤ ਵਧੀਆ ਹੋ ਜਾਂਦੀ ਹੈ